ਹੈਲੋ ਹਾਂਜੀ ਅਸੀਂ ਕੱਪੜੇ ਖਰੀਦਣੇ ਨੇ ਸਰ ਵਿਆਹ ਦਾ ਪ੍ਰੋਗਰਾਮ ਹੈ ਅਤੇ ਅਸੀਂ ਹੰਡਾਏ ਤੋਂ ਬੋਲ ਰਹੇ ਹਾਂ ਸਾਨੂੰ ਕੋਟ ਪੈਂਟ ਦਾ ਵਧੀਆ ਕੱਪੜਾ ਬਲਿਊ ਰੰਗ 'ਚ ਅਤੇ ਮਿਲ ਜੇਗਾ ਹੋਰ ਬੱਚਿਆਂ ਦਾ ਸ਼ਰਟ ਬੱਚਿਆਂ ਦੇ ਕੱਪੜੇ ਜਿਵੇਂ ਮੁੰਡਾ ਆ ਉਹਦੀ ਪੈਂਟ ਸ਼ਰਟ ਲੜਕੀ ਆ ਉਹਦੇ ਵਾਸਤੇ ਫਰਾਕ ਵਗੈਰਾ ਇਹੋ ਜਿਹਾ ਸਮਾਨ ਚਾਹੀਦਾ ਉਹ ਵੀ ਮਿਲ ਜੂਗਾ ਦੇਖੋ ਦਸ ਸਾਲ ਦਾ ਲੜਕਾ ਹੈ ਬਾਰ੍ਹਾਂ ਚੌਦ੍ਹਾਂ ਸਾਲ ਦੀ ਲੜਕੀ ਹੈ ਉਹਨਾਂ ਵਾਸਤੇ ਚਾਹੀਦੇ ਨੇ ਬਾਕੀ ਲੇਡੀਜ਼ ਸੂਟ ਵੀ ਚਾਹੀਦੇ ਨੇ ਜਿ ਜਿਵੇਂ ਸਾੜੀ ਵਗੈਰਾ ਹੋਰ ਜਿਵੇਂ ਸੂਟ ਵਧੀਆ ਵਧੀਆ ਆਏ ਨੇ ਅੱਛਾ ਜੀ ਅਸੀਂ ਸਾਰਾ ਪਰਿਵਾਰ ਆਵਾਂਗੇ ਕਿਹੜੇ ਦਿਨ ਆਈਏ ਸਾਨੂੰ ਕੋਈ ਇਹਦੇ ਵਿੱਚ ਟੋਟਲ 'ਚ ਅਮਾਊਂਟ 'ਚ ਕੋਈ ਡਿਸਕਾਊਂਟ ਕਰੂੰਗੇ ਠੀਕ ਹੈ ਜੀ ਹੋਰ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ